ਦਰਅਸਲ ਇਹ ਫੈਸਲਾ ਕਰਨਾ ਸਭ ਤੋਂ ਔਖਾ ਹੁੰਦਾ ਕਿ ਅੱਜ ਕੀ ਬਣਾਇਆ ਜਾਵੇ ਇਹ ਕਿਸੇ ਖਾਸ ਵਿਸ਼ੇ ਵਸਤੂ 'ਤੇ ਨਿਰਭਰ ਨਹੀਂ ਕਰਦਾ ਅਕਸਰ ਜੋ ਮਨ 'ਚ ਆਉਂਦਾ ਹੈ ਜਾਂ ਜਿੱਦਨ ਮਨ ਦੇ ਜੋ ਭਾਵ ਹੁੰਦੇ ਹਨ ਉਹ ਉਸ ਤਰ੍ਹਾਂ ਉਹਨਾਂ ਦੇ ਹਿਸਾਬ ਨਾਲ ਮੈਂ ਕੀ ਬਣਾਉਣਾ ਇਹ ਨਿਸ਼ਚਿਤ ਕਰਦੀ ਹਾਂ ਜਿੱਦਾਂ ਅੱਜ ਸਮਝੋ ਮੈਂ ਆਪਣੀ ਮਿੱਤਰਾਂ ਨਾਲ ਘੁੰਮਣ ਗਈ ਅਤੇ ਉੱਥੇ ਸੋਹਣੇ ਦ੍ਰਿਸ਼ ਦੇਖੇ ਕੁਝ ਚੰਗਾ ਖਾਇਆ ਮਨ ਦੇ ਅੰਦਰ ਬੜੇ ਚੰਗੇ ਭਾਵ ਉਚਰੇ ਹਨ ਅਤੇ ਯਾਦਾਂ ਨੂੰ ਮੈਂ ਸੰਭਾਲ ਕੇ ਰੱਖਣਾ ਚਾਹੁੰਦੀ ਹਾਂ ਤਾਂ ਮੈਂ ਸ਼ਾਮ ਨੂੰ ਘਰ ਆਈ ਅਤੇ ਸੋਚਿਆ ਕਿ ਇਹ ਸਾਰੇ ਜਿਹੜੇ ਪੂਰੇ ਦਿਨ ਦੇ ਖਿਆਲ ਹਨ ਇਹਨਾਂ ਨੂੰ ਕਿਵੇਂ ਚਿਤਰਿਆ ਜਾਵੇ ਅਤੇ ਕਿਵੇਂ ਚਿੱਤਰਿਆ ਜਾਵੇ ਤਾਂ ਮੈਂ ਕੀ ਕਰਦੀ ਹਾਂ ਕਿ ਕਲਪਨਾ ਦੇ ਅੰਦਰ ਜਿੱਦਾਂ ਹਰ ਹਰ ਭਾਵ ਨਾਲ ਕੋਈ ਨਾ ਕੋਈ ਰੰਗ ਮੇਲ ਖਾਂਦਾ ਹੁੰਦਾ ਪੀਲਾ ਅਕਸਰ ਖੁਸ਼ੀ ਚੰਗੇ ਅਤੇ ਚੰਗੇ ਭਾਵਾਂ ਨੂੰ ਦਰਸਾਉਂਦਾ ਹੈ ਜਿਵੇਂ ਨੀਲਾ ਲੈ ਕੇ ਨੀਲਾ ਕੁਝ ਉਦਾਸੀ ਹੋ ਗਈ ਜਾਂ ਫਿਰ ਤੜਕੇ ਦਾ ਜਿਹੜਾ ਮਨ ਦੀ ਸ਼ਾਂਤੀ ਹੁੰਦੀ ਹੈ ਉਹਨੂੰ ਵੀ ਦਰਸਾਇਆ ਜਾ ਸਕਦਾ ਹੈ ਲਾਲ ਰੰਗ ਨਾਲ ਤੁਸੀਂ ਕੀ ਕਰਨਾ ਚਾਹੁੰਦੇ ਹੋ ਬੜੇ ਉੱਚੇ ਖਿਆਲ ਅੱਗ ਹੈ ਨਾ ਅਤੇ ਗੁੱਸਾ ਜਾਂ ਫਿਰ ਪਿਆਰ ਤਾਂ ਇੱਦਾਂ ਰੰਗ ਚਿੱਤਰ ਇਮੇਜਿਸ ਅਤੇ ਭਾਵ ਇਹ ਤਿੰਨਾਂ ਦਾ ਬੜਾ ਗੂੜਾ ਸੰਬੰਧ ਹੁੰਦਾ ਅਤੇ ਇਹਨਾਂ ਨੂੰ ਕਿੱਦਾਂ ਵਰਤਣਾ ਹੈ ਅਤੇ ਅੱਜ ਦੇ ਦਿਨ ਦੇ ਨਾਲ ਕਿਹੜੇ ਕਿੱਦਾਂ ਵਰਤਿਆ ਜਾ ਸਕਦਾ ਇਹਨਾਂ ਨੂੰ ਰਲ ਮਿਲਾ ਕੇ ਸੋਚ ਕੇ ਭਾਵ ਆ ਰਹੇ ਹਨ ਖਾਲੀ ਕਾਗਜ਼ 'ਤੇ ਜਿੱਦਾਂ ਉਤਰ ਗਏ ਉਤਰੇ ਕੁਝ ਆਪਣੇ ਆਪ 'ਤੇ ਕੁਝ ਸੋਚ ਸਮਝ ਕੇ ਘੜ ਘੜ ਕੇ ਵਿਚਾਰ ਵਿਚਾਰ ਕੇ ਅਤੇ ਇੱਦਾਂ ਫਿਰ ਮੈਂ ਆਪਣਾ ਥੀਮ ਵੀ ਨਿਸ਼ਚਿਤ ਕਰਦੀ ਹਾਂ ਅਤੇ ਦੂਜਾ ਜੇ ਕੁਝ ਖਾਸ ਨਹੀਂ ਆ ਰਿਹਾ ਮਨ ਦੇ ਅੰਦਰ ਵੈਸੇ ਹੀ ਕੁਛ ਬਣਾਉਣ ਦਾ ਮਨ ਹੋ ਰਿਹਾ ਉਹ ਹੋ ਗਿਆ ਕੋਈ ਗਮਲਾ ਪਿਆ ਜਾ ਕੋਈ ਤੁਰਿਆ ਜਾਂਦਾ ਕੋਈ ਚੰਗਾ ਲੱਗਿਆ ਕੋਈ ਬਜ਼ੁਰਗ ਬੈਠੇ ਹਨ ਉਹਨਾਂ ਨੂੰ ਆਪਣੇ ਕਾਗਜ਼ 'ਤੇ ਉਤਾਰਨ ਦਾ ਮਨ ਕੀਤਾ ਇੱਦਾਂ ਆਮ ਰੋਜ਼ ਤੇ ਕਾਰ ਵਿਹਾਰ ਵਾਲੇ ਜੀਵਨ ਦੇ ਵਿੱਚੋਂ ਦ੍ਰਿਸ਼ ਹੋਗੇ ਕਾਰਜ ਹੋ ਗਏ ਲੋਕ ਹੋ ਗਏ ਉਹਨਾਂ ਨੂੰ ਜੇ ਕੋਈ ਖਾਸ ਕੋਈ ਖਾਸ ਬੰਦਾ ਨਹੀਂ ਹੈ ਆਪਣੇ ਮਨ ਤੋਂ ਖੁਦ ਇੱਕ ਚਰਿੱਤਰ ਨੂੰ ਘੜ ਕੇ ਜਿੱਦਾਂ ਕੋਈ ਚੌਦਾਂ ਪੰਦਰਾਂ ਸਾਲਾਂ ਦੀ ਚਿੱਤਰਕਾਰ ਲੜਕੀ ਜਾਂ ਕੋਈ ਕੰਮ ਕਰਦਾ ਮਜ਼ਦੂਰ ਆਪਣੇ ਆਪ ਚਿਤਵਕੇ ਕਲਪਨਾ ਕਰਕੇ ਉਹਨਾਂ ਨੂੰ ਘੜਨਾ ਉਹਨਾਂ ਦੀਆਂ ਅੱਖਾਂ ਕਿੱਦਾਂ ਦੀਆਂ ਬਣਾਉਣੀਆਂ ਹੈ ਉਹਨਾਂ ਦੇ ਕੇਸਾਂ ਦਾ ਰੰਗ ਬਾਲਾਂ ਦਾ ਰੰਗ ਉਹਨਾਂ ਦੀ ਹਾਈਟ ਜਿਹੜੀ ਹੈ ਉਹ ਕਿੰਨੀ ਉਚਾਈ ਉਹਨਾਂ ਦੇ ਹੱਥ ਕਿੱਦਾਂ ਦੇ ਝੁਰੜੀਆਂ ਕਿੱਦਾਂ ਦੀਆਂ ਬਣਾਉਣੀਆਂ ਬਜ਼ੁਰਗ ਦੇ ਹੈ ਨਾ ਤਾਂ ਇਹ ਇਹ ਸਾਰੇ ਚਰਿੱਤਰ ਆਪਣੇ ਖੁਦ ਦੇ ਖਿਆਲਾਂ 'ਚੋਂ ਘੜ ਕੇ ਉਹਨਾਂ ਨੂੰ ਕਾਗਜ਼ 'ਤੇ ਉਤਾਰਨਾ ਇਹਦੇ ਨਾਲ ਇੱਕ ਤਾਂ ਅਭਿਆਸ ਹੋ ਜਾਂਦਾ ਵੱਖ ਵੱਖ ਚਿੱਤਰਕਾਰੀ ਦੇ ਅੰਗਾਂ ਦਾ ਦੂਜਾ ਅਤੇ ਅ ਕਲਪਨਾ ਵੀ ਤੇਜ਼ ਹੋ ਜਾਂਦੀ ਹੈ ਅਤੇ ਅਤੇ ਬਾਕੀ ਮਨ ਦੇ ਭਾਵਾਂ 'ਤੇ ਜ਼ਿਆਦਾਤਰ ਨਿਸ਼ਚਿਤ ਨਿਰਭਰ ਕਰਦਾ ਕਿ ਕੀ ਬਣਾਇਆ ਜਾਵੇ ਕੋਈ ਪੱਕਾ ਨਿਸ਼ਚਿਤ ਕੋਈ ਰੂਲ ਨਹੀਂ ਹੈਗਾ